ਹੈਲੋ ਮੈਂ ਮਨਜੋਤ ਬੋਲ ਰਹੀ ਹਾਂ ਕੱਲ੍ਹ ਮੈਂ ਇੱਕ ਕੈਬ ਬੁੱਕ ਕਰਵਾਈ ਸੀਗੀ ਤਰਨ ਤਾਰਨ ਤੋਂ ਜੰਡਿਆਲਾ ਜਾਣ ਵਾਸਤੇ ਕੁਛ ਰੀਜ਼ਨ ਕਰਕੇ ਉਹ ਮੈਨੂੰ ਕੈਂਸਲ ਕਰਨੀ ਪਏਗੀ ਐਕਚੁਲੀ ਆਲ ਆਫ ਸਡਨ ਮੇਰੇ ਨਾਨੀ ਦੀ ਤਬੀਅਤ ਥੋੜ੍ਹੀ ਖਰਾਬ ਹੋ ਗਈ ਆ ਸੋ ਮੈਨੂੰ ਉੱਥੇ ਜਾਣਾ ਪੈ ਰਿਹਾ ਵਾ ਔਰ ਐਕਚੁਲੀ ਉਹ ਜੋ ਕੈਬ ਸੀ ਉਹਦੀ ਪੇਮੈਂਟ ਮੈਂ ਆਲਰੇਡੀ ਕਰ ਦਿੱਤੀ ਹੋਏਗੀ ਔਨਲਾਈਨ ਪੇਮੈਂਟ ਦੋ ਹਜ਼ਾਰ ਰੁਪਏ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹਦਾ ਭੁਗਤਾਨ ਮੈਨੂੰ ਕਰ ਦਿਉ ਮਤਲਬ ਪੇਸ਼ਗੀ ਜੋ ਵੀ ਹੋਈ ਆ ਉਹ ਤੁਸੀਂ ਮੈਨੂੰ ਵਾਪਸ ਕਰ ਦਿਉ ਕਿਉਂਕਿ ਹੁਣ ਜਿੱਦਾਂ ਮੈਨੂੰ ਜਾਣਾ ਪੈ ਰਿਹਾ ਵਾ ਸੋ ਦੋ ਹਜ਼ਾਰ ਦੀ ਜਿਹੜੀ ਰਕਮ ਆ ਤੁਸੀਂ ਪਲੀਜ਼ ਮੈਨੂੰ ਕੈਸ਼ ਰਿਫੰਡ ਕਰ ਦਿ ਦਿਉ ਔਰ ਬਾਕੀ ਇਹ ਆ ਕਿ ਜੋ ਮਤਲਬ ਮੇਰਾ ਅਕਾਊਂਟ ਨੰਬਰ ਤਾਂ ਤੁਹਾਡੇ ਕੋਲ ਹੈ ਹੀ ਆ ਸੋ ਇਹ 'ਤੇ ਤੁਸੀਂ ਮੈਨੂੰ ਰਿਫੰਡ ਕਰ ਦਿਉ ਬਾਕੀ ਅਸੁਵਿਧਾ ਲਈ ਖੇਦ ਆ ਮਤਲਬ ਜੋ ਵੀ ਤੁਹਾਨੂੰ ਪ੍ਰੇਸ਼ਾਨੀ ਹੋਈ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ